ਪੰਜਾਬ 'ਚ ਇਸ ਐਦਾਂ ਦੀਆਂ ਬਹੁਤ ਹੀ ਜਗ੍ਹਾ ਹਨ ਜਿਸ ਬਾਰੇ ਲੋਕਾਂ ਨੂੰ ਜ਼ਿਆਦਾ ਟੂਰਿਸਟਾਂ ਨੂੰ ਮਤਲਬ ਨਹੀਂ ਪਤਾ ਹੈ ਜਿਵੇਂ ਕਿ ਆਪਣੇ ਫਲਾਇੰਗ ਫੋਕਸ ਇਹ ਆਪਣੇ ਰੂਪਨਗਰ 'ਚ ਪੈਂਦਾ ਹੈ ਪੰਜਾਬ ਨੂਪ ਰੂਪਨਗਰ 'ਚ ਪੈਂਦਾ ਹੈ ਅਤੇ ਐਡਵੈਂਚਰ ਪਾਰਕ ਹੈ ਜਿਸ ਬ ਜਿਸ ਬਾਰੇ ਲੋਕਾਂ ਨੂੰ ਬਹੁਤ ਹੀ ਘੱਟ ਘੱਟ ਪਤਾ ਹੈ ਜਿਸ ਤਰ੍ਹਾਂ ਕਿ ਆਪਣੇ ਹਰੀਕੇ ਪੱਤਣ ਜੋ ਕਿ ਅੰਬਰਸਰ ਦੇ ਅੰਬਰਸਰ ਤੋਂ ਕੋਈ ਵੀਹ ਤੀਹ ਕਿਲੋਮੀਟਰ ਹੈ ਹਰੀਕੇ ਉਹਦੀ ਹਰੀਕੇ ਪੱਤਣ ਦੀ ਪਾਰਕ ਹੈਗੀ ਹੈ ਉੱਥੇ ਵੀ ਡੈਮ ਹੈਗਾ ਉੱਥੇ ਮਤਲਬ ਇਹੋ ਜਿਹੀਆਂ ਬਹੁਤ ਹੀ ਚੀਜ਼ਾਂ ਹਨ ਜਿਸ ਬਾਰੇ ਲੋਕਾਂ ਨੂੰ ਘੱਟ ਪਤਾ ਹੈ ਸਾਡੇ ਪਠਾਨਕੋਟ ਪੰਜਾਬ ਦੇ ਲਾਗੇ ਇੱਕ ਧਾਰਕਲਾਂ ਪੈਂਦਾ ਹੈ ਜਿਸ ਵਿੱਚ ਮਤਲਬ ਮਿੰਨੀ ਗੋਆ ਹੈ ਉਸ ਉੱਥੇ ਵੀ ਲੋਕਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਹੈ ਬਟ ਉਹ ਇੱਕ ਹਿਸਾਬ ਦਾ ਮਿੰਨੀ ਗੋਆ ਉਹਨੂੰ ਕਿਹਾ ਜਾਂਦਾ ਹੈ ਜਿਸਦੀ ਮਤਲਬ ਕਿ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਾਂ ਕਿਸ ਤਰ੍ਹਾਂ ਨਹੀਂ ਬਟ ਹੈ ਟੂਰਿਸਟ ਪਲੇਸ ਹੈ ਬਟ ਟੂਰਿਸਟ ਉੱਥੇ ਨਹੀਂ ਜਾਂਦੇ ਹੈ ਟੂਰਿਸਟ ਹਿਮਾਚਲ ਵਗੈਰਾ ਘੁੰਮਣ ਜਾਂਦੇ ਹਨ ਬਟ ਜੋ ਕਿ ਆਪਣੇ ਪੰਜਾਬ ਵਿੱਚ ਹੀ ਇਹੋ ਜਿਹੀਆਂ ਜਗ੍ਹਾ ਹਨ ਜਿੱਥੇ ਲੋਕ ਘੁੰਮਣ ਫਿਰਨ ਦਾ ਪਤਾ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਦਾ ਆਪਣੇ ਮਾਹੌਲ ਹੈ ਜਾਂ ਕਿਸ ਤਰ੍ਹਾਂ ਦਾ